ਇੱਕ ਖੂਹ ਦੇ ਵਿੱਚ ਪਾਣੀ ਕੱਢਣ ਲਈ ਤਾਂ ਆਪਾਂ ਨੂੰ ਉਹਦੇ ਵਿੱਚ ਮੋਟਰ ਲਗਾਈ ਜਾਂਦੀ ਉਹਦੇ ਵਿੱਚ ਪਾਈਪ ਲਗਾ ਕੇ ਤਾਂ ਕਾਫ਼ੀ ਜ਼ਿਆਦਾ ਵਧੀਆ ਤਰੀਕੇ ਨਾਲ ਪਾਣੀ ਉੱਪਰ ਪਹੁੰਚਾਇਆ ਜਾਂਦਾ ਜੋ ਕਿ ਆਪਣੇ ਆਪ ਨੂੰ ਸਾਨੂੰ ਵਧੀਆ ਤਰੀਕੇ ਨਾਲ ਪਾਣੀ ਮਿਲ ਜਾਵੇ